ਮੈਂ ਸ਼ੋਸ਼ਲ ਮੀਡੀਆ 'ਤੇ ਡਾਂਸ ਨਹੀਂ ਕਰਦੀ ਅਤੇ ਮੈਨੂੰ ਇਹ ਕਰਨਾ ਪਸੰਦ ਵੀ ਨਹੀਂ ਹੈ ਕਿਉਂਕਿ ਹਰ ਇੱਕ ਦਾ ਆਪਣਾ ਫੈਮਿਲੀ ਬੈਕਗ੍ਰਾਊਂਡ ਹੁੰਦਾ ਏ ਅਤੇ ਸਾਡੀ ਫੈਮਿਲੀ ਇਹ ਸਭ ਕਰਨ ਲਈ ਸਾਨੂੰ ਅਲਾਓ ਨਹੀਂ ਕਰਦੀ ਅਤੇ ਸਾਨੂੰ ਖ਼ੁਦ ਨੂੰ ਵੀ ਇਹ ਚੰਗਾ ਨਹੀਂ ਲੱਗਦਾ ਇਸ ਕਰਕੇ ਅਸੀਂ ਸ਼ੋਸ਼ਲ ਮੀਡੀਆ 'ਤੇ ਡਾਂਸ ਨਹੀਂ ਕਰਦੇ